ਮੈਂ ਕਵਿਤਾਵਾਂ ਲਿਖਣ ਦਾ ਸ਼ੌਂਕ ਰੱਖਦਾ ਹਾਂ ਸੰਡੇ ਵਾਲੇ ਦਿਨ ਮੈਂ ਨਦੀ ਦੁਆਰੇ ਪਹੁੰਚ ਕੇ ਠੰਡੀ ਪੇੜ ਦੀ ਰੁੱਖ ਹੇਠਾਂ ਬੈਠ ਕੇ ਆਪਣੀ ਕਵਿਤਾਵਾਂ ਲਿਖਦਾ ਹਾਂ ਠੰਡੀ ਠੰਡੀ ਪੇੜ ਦੀ ਛਾਂ ਵਿੱਚ ਬਹਿ ਕੇ ਕਵਿਤਾਵਾਂ ਲਿਖਣ ਦਾ ਆਨੰਦ ਬਹੁਤ ਹੀ ਵਧੀਆ ਹੁੰਦਾ ਹੈ ਮਾਵਾਂ ਠੰਡੀਆਂ ਛਾਵਾਂ ਹੁੰਦੀਆਂ ਇਹ ਮੇਰੀ ਪਸੰਦੀਦਾ ਕਵਿਤਾ ਹੈ ਕਵਿਤਾ ਲਿਖਣ ਦਾ ਸ਼ੌਂਕ ਮੈਨੂੰ ਬਹੁਤ ਪਹਿਲਾਂ ਦਾ ਹੀ ਹੈ ਜਦੋਂ ਮੈਂ ਪਲੱਸ ਜਦੋਂ ਮੈਂ ਪਹਿਲੀ ਦੂਜੀ ਕਲਾਸ ਵਿੱਚ ਹੁੰਦਾ ਸੀ ਉਦੋਂ ਤੋਂ ਹੀ ਮੈਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਪੈ ਗਿਆ ਸੀ ਪੰਜਾਬੀ ਦੀ ਪੁਸਤਕ ਵਿੱਚ ਅਸੀਂ ਵੱਖ ਵੱਖ ਰਾਈਟਰਾਂ ਦੀ ਕਵਿਤਾਵਾਂ ਜਦੋਂ ਸੁਣਦੇ ਤਾਂ ਉਹਨਾਂ ਨੂੰ ਦੇ ਕੇ ਇੰਨੀ ਜ਼ਿਆਦਾ ਪ੍ਰੇਰਨਾ ਮਿਲਦੀ ਅਤੇ ਉਹਨਾਂ ਦੀ ਪ੍ਰੇਰਨਾ ਰਾਹੀਂ ਹੀ ਮੈਨੇ ਕਵਿਤਾਵਾਂ ਲਿਖਣ ਦਾ ਸ਼ੌਂਕ ਆਪਣੇ ਅੰਦਰ ਬਣਾਇਆ ਅਤੇ ਉਸ ਸ਼ੌਂਕ ਨੂੰ ਸਾਕਾਰ ਵੀ ਕਰਿਆ